ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈਗਾ ਜਿਹੜੀ ਪੰਜਾਬ ਦੀ ਮਾਤ ਭਾਸ਼ਾ ਹੈਗੀ ਪੰਜਾਬੀ ਹੈ ਤਾਂ ਉਹ ਇਸ ਲਈ ਕੀ ਹੈ ਇਸ ਲਈ ਜੋ ਉਹਦੇ ਪੰਜਾਬ ਦੀ ਆਰਥਿਕਤਾ ਨੂੰ ਜੋ ਚੀਜ਼ ਦਰਸਾਉਂਦੀ ਹੈਗੀ ਉਹ ਪੰਜਾਬੀ ਦੇ ਵਿੱਚ ਹੀ ਜ ਹੋਊਗੀ ਠੀਕ ਹੈ ਵਸਤਾਂ ਦਾ ਆਦਾਨ ਪ੍ਰਦਾਨ ਹੋ ਗਿਆ ਕੋਈ ਬਿਜ਼ਨਸ ਹੋ ਗਿਆ ਠੀਕ ਹੈ ਆਪਣਾ ਜਿਵੇਂ ਕਿਸੇ ਚੀਜ਼ ਦੀ ਐਡਵਰਟੀਜਮੈਂਟ ਉਸ ਚੀਜ਼ ਦੀ ਐਡ ਕਰਨੀ ਹੈਗੀ ਆ ਉਹ ਪੰਜਾਬੀ ਦੇ ਵਿੱਚ ਹੋਊਗੀ ਹੁਣ ਜਿਵੇਂ ਦੁਕਾਨਾਂ ਦੇ ਬਾਹਰ ਬੋਰਡ ਲੱਗੇ ਹੁੰਦੇ ਹੈਗੇ ਆ ਉਹ ਪੰਜਾਬੀ ਦੇ ਵਿੱਚ ਹੁੰਦੇ ਹੈਗੇ ਆ ਅਖਬਾਰ ਵਗੈਰਾ ਜਿਹੜੇ ਹੈਗੇ ਆ ਉਹ ਪੰਜਾਬੀ ਦੇ ਵਿੱਚ ਆਉਂਦੇ ਹੈਗੇ ਹੈ ਠੀਕ ਹੈ ਕਿਸੇ ਚੀਜ਼ ਦਾ ਇਸ਼ਤਿਹਾਰ ਦੇਣਾ ਹੈਗਾ ਪੰਫਲੈਟਸ ਵਗੈਰਾ ਵੰਡੇ ਜਾਂਦੇ ਉਹ ਪੰਜਾਬੀ ਦੇ ਵਿੱਚ ਹੁੰਦੇ ਹੈਗੇ ਆ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਥਾਨਕ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹੈਗੀਆਂ ਸਥਾਨਕ ਕੀ ਜੋ ਬਾਹਰਲੇ ਰਾਜਾਂ ਤੋਂ ਹੋਰ ਬਾਹਰ ਕੰਟਰੀਸ ਤੋਂ ਲੋਕ ਆਉਂਦੇ ਹੈਗੇ ਪੰਜਾਬ ਦੇ ਵਿੱਚ ਉਹਨਾਂ ਨੂੰ ਜ਼ਿਆਦਾਤਰ ਕਿ ਪੰਜਾਬੀ ਦੇਖਣ ਨੂੰ ਮਿਲਦੀ ਹੈਗੀ ਹੈ ਤਾਂ ਉਹ ਮਤਲਬ ਇਸ ਚੀਜ਼ ਤੋਂ ਪ੍ਰਭਾਵਿਤ ਹੁੰਦੇ ਹੈਗੇ ਕਿ ਪੰਜਾਬ ਦੇ ਲੋਕ ਨੇ ਪੰਜਾਬੀ ਨੂੰ ਇੰਨੀ ਜ਼ਿਆਦਾ ਪ੍ਰੈਫਰੈਂਸ ਦਿੰਦੇ ਹੈਗੇ ਆ ਤਾਂ ਹੋਣੀ ਵੀ ਚਾਹੀਦੀ ਹੈਗੀ ਆ ਉਹਦੇ ਵਿੱਚ ਕੀ ਹੈ ਕਿ ਜੋ ਕਿਸੇ ਤਰ੍ਹਾਂ ਦਾ ਵਪਾਰ ਕਰਨਾ ਹੈਗਾ ਠੀਕ ਹੈ ਉਹ ਵੀ ਪੰਜਾਬੀ ਦੇ ਵਿੱਚ ਜਿਹੜੀ ਮੀਟਿੰਗ ਕਾਨਫਰੰਸਸ ਹੁੰਦੀਆਂ ਹੈਗੀਆਂ ਪੰਜਾਬੀ ਦੇ ਵਿੱਚ ਹੋਣੀਆਂ ਚਾਹੀਦੀਆਂ ਵਣਜ ਦੇ ਵਿੱਚ ਵੀ ਕੀ ਹੈ ਚੀਜ਼ਾਂ ਦਾ ਅਦਾਨ ਪ੍ਰਦਾਨ ਹੈਗਾ ਅਤੇ ਉਹਦਾ ਜੋ ਵੀ ਲਿਖਤੀ ਨੋਟਿਸ ਹੈਗਾ ਲਿਖਤੀ ਜਿਹੜਾ ਹੈਗਾ ਪੱਤਰ ਹੈਗਾ ਉਹ ਪੰਜਾਬੀ ਦੇ ਵਿੱਚ ਹੁੰਦਾ ਹੈਗਾ ਕਿਉਂਕਿ ਪੰਜਾਬੀ ਦੇ ਵਿੱਚ ਕਰਦੇ ਹੈਗੇ ਅਤੇ ਹੁਣ ਮਤਲਬ ਹਾਂ ਪਿੱਛੇ ਜਿਹੇ ਇੱਕ ਮਤਲਬ ਰੂਲ ਸੀਗਾ ਕਿ ਪੰਜਾਬ ਦੇ ਜਿਹੜੇ ਵਿੱਦਿਅਕ ਅਦਾਰੇ ਹੈਗੇ ਕੋਈ ਵੀ ਮਤਲਬ ਸਰਕਾਰੀ ਅਦਾਰਾ ਹੈਗਾ ਠੀਕ ਹੈ ਉਹਦੇ ਵਿੱਚ ਕੀ ਹੈ ਜੋ ਵੀ ਮਤਲਬ ਅਹੁਦੇਦਾਰ ਹੁੰਦੇ ਹੈਗੇ ਆ ਉਹਨਾਂ ਨੂੰ ਆਪਣੇ ਪੰਜਾਬੀ ਦੇ ਵਿੱਚ ਸਾਈਨ ਕਰਨੇ ਜ਼ਰੂਰੀ ਹੈ ਪੰਜਾਬੀ ਦੇ ਵਿੱਚ ਸਾਈਨ ਕਰਨੇ ਜ਼ਰੂਰੀ ਹੈ ਮਤਲਬ ਠੀਕ ਹੈ ਪੰਜਾਬੀ ਇਸ ਲਈ ਲਾਜ਼ਮੀ ਹੋ ਜਾਂਦੀ ਹੈਗੀ ਹੈ ਉੱਥੇ ਤਾਂ ਜਿਹੜੀ ਪੰਜਾਬ ਦੀ ਜਿਹੜੀ ਭਾਸ਼ਾ ਹੈਗੀ ਪੰਜਾਬੀ ਠੀਕ ਹੈ ਸਥਾਨਕ ਆਰਥਿਕਤਾ ਵਿੱਚ ਬਹੁਤ ਪ੍ਰਭਾਵ ਪਾਉਂਦੀ ਹੈਗੀ ਹੈ ਵਪਾਰ ਅਤੇ ਵਣਜ ਵਿੱਚ ਵੀ ਕੀ ਹੈ ਆਪਦਾ ਪ੍ਰਭਾਵ ਪਾਉਂਦੀ ਹੈਗੀ ਹੈ ਅਤੇ ਉਹਨਾਂ ਦੀ ਬਹੁਤ ਜ਼ਿਆਦਾ ਇੱਥੇ ਇੰਮਪੋਰਟੈਂਸ ਹੈਗੀ ਵੈਲਿਊ ਹੈਗੀ ਆ ਜੀ